ਹਾਂ ਮੈਨੂੰ ਇਹ ਲੱਗਦਾ ਹੈ ਕਿ ਹੋਰ ਕਿਸੇ ਹੋਰ ਗ੍ਰਹਿ 'ਤੇ ਜੀਵਨ ਸੰਭਵ ਹੈ ਭਾਵੇਂ ਕਿ ਅਜੇ ਤੱਕ ਵਿਗਿਆਨੀ ਇਹ ਸੱਚ ਸਾਬਤ ਨਹੀਂ ਕਰ ਪਾਏ ਪਰ ਇਹ ਹੈ ਤਾਂ ਸੱਚ ਹੀ ਅੱਜ ਵੀ ਸਾਡੇ ਕਈ ਪ੍ਰਮਾਣ ਹਨ ਜਿਨ੍ਹਾਂ ਵਿੱਚ ਐਲੀਅਨਸ ਹੋਣ ਬਾਰੇ ਸ਼ੱਕ ਹੈ ਐਲੀਅਨਸ ਹੋਰ ਕੁਝ ਨਹੀਂ ਦੂਜੇ ਗ੍ਰਹਿਆਂ ਦੇ ਲੋਕ ਹਨ ਜੋ ਸਾਡੀ ਧਰਤੀ ਨੂੰ ਖੋਜਣ ਆਉਂਦੇ ਹਨ ਇਹਨਾਂ ਚੀਜ਼ਾਂ ਉੱਪਰ ਫਿਲਮਾਂ ਤਾਂ ਬਹੁਤ ਬਣਦੀਆਂ ਹਨ ਪਰ ਹਕੀਕਤ ਵਿੱਚ ਇਸ ਗੱਲ ਨੂੰ ਸਾਬਤ ਕਰਨ ਲਈ ਅਜੇ ਹੋਰ ਸਮਾਂ ਲੱਗੇਗਾ ਮੁੱਕਦੀ ਗੱਲ ਗੁਰਬਾਣੀ ਸਾਨੂੰ ਇਹ ਸਭ ਗੱਲਾਂ ਤੋਂ ਉੱਚਾ ਉੱਠ ਕੇ ਆਪਣੇ ਅੰਦਰ ਨੂੰ ਲੱਭਣ ਬਾਰੇ ਵੀ ਦੱਸਦੀ ਹੈ